ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਨੂੰ ਲੱਗਦਾ ਹੈ ਕਿ ਇੰਟਰਨੈਟ ਨੇ ਬੈਂਕਿੰਗ ਅਤੇ ਲੈਣ ਦੇਣ ਦਾ ਤਰੀਕਾ ਬਦਲ ਕੇ ਰੱਖ ਦਿੱਤਾ ਹੈ ਹੁਣ ਕਿਸੇ ਤੋਂ ਵੀ ਲੈਣ ਦੇਣ ਵਾਸਤੇ ਸਾਨੂੰ ਉਸ ਤੋਂ ਪੈਸਿਆਂ ਦੇ ਨਾਲ ਲੈਣਾ ਦੇਣਾ ਨਹੀਂ ਪੈਂਦਾ ਹੁਣ ਇੰਟਰਨੈੱਟ ਦੇ ਨਾਲ ਹੀ ਅਸੀਂ ਹਰ ਕੁਛ ਲੈਣ ਦੇਣ ਕਰ ਸਕਦੇ ਹਾਂ ਅਤੇ ਸਾਨੂੰ ਹੁਣ ਆਪਣੇ ਕੋਲ ਪੈਸੇ ਵੀ ਰੱਖਣ ਦੀ ਲੋੜ ਨਹੀਂ ਪੈਂਦੀ ਹੁਣ ਫੋਨ ਦੇ ਵਿੱਚ ਬਹੁਤ ਸਾਰੇ ਐਪ ਹਨ ਜਿਨ੍ਹਾਂ ਨਾਲ ਆਪਾਂ ਇਹ ਪੈਸਿਆਂ ਦਾ ਲੈਣ ਦੇਣ ਕਰ ਸਕਦੇ ਹਾਂ ਅਤੇ ਚਾਹੇ ਇਨਸਾਨ ਕਿੰਨੀ ਵੀ ਦੂਰ ਹੋਵੇ ਜਾਂ ਸਾਡੇ ਤੋਂ ਕਿੰਨਾ ਵੀ ਦੂਰ ਹੋਵੇ ਅਸੀਂ ਪੈਸਿਆਂ ਨਾਲ ਉਸ ਦੀ ਮਦਦ ਕਰ ਸਕਦੇ ਹਾਂ ਤਾਂ ਪੈਸੇ ਨਾਲੇ ਪੈਸੇ ਉਸ ਤੱਕ ਪਹੁੰਚਾ ਸਕਦੇ ਹਨ ਇਹਨਾਂ ਵਿੱਚੋਂ ਬਹੁਤ ਸਾਰੇ ਪ੍ਰਸਿੱਧ ਐਪ ਹਨ ਜਿਵੇਂ ਕਿ ਗੂਗਲ ਪੇ ਹੈ ਪੇਟੀਐੱਮ ਹੈ ਇਸ ਤਰ੍ਹਾਂ ਹੀ ਬਹੁਤ ਸਾਰੇ ਆਧੁਨਿਕ ਐਪ ਹਨ ਜਿਨ੍ਹਾਂ ਨਾਲ ਆਪਾਂ ਕਿਸੇ ਵੀ ਪੈਸੇ ਦਾ ਲੈਣ ਦੇਣ ਕਰ ਸਕਦੇ ਹਾਂ ਹਾਂ ਕਦੇ ਕਦੇ ਸਾਨੂੰ ਬੈਂਕ ਵੀ ਜਾਣਾ ਪੈਂਦਾ ਹੈ ਕਿਉਂਕਿ ਜਦੋਂ ਜੋ ਰਕਮ ਬਹੁਤ ਵੱਡੀ ਹੁੰਦੀ ਹੈ ਜਾਂ ਸਾਨੂੰ ਵੱਡੀ ਰਕਮ ਜਮ੍ਹਾਂ ਕਰਨੀ ਹੁੰਦੀ ਹੈ ਜਾਂ ਕਿਸੇ ਤੋਂ ਲੈਣੀ ਹੁੰਦੀ ਹੈ ਜਾਂ ਦੇਣੀ ਹੁੰਦੀ ਹੈ ਸਾਨੂੰ ਉਸ ਸਮੇਂ ਵਿੱਚ ਬੈਂਕ ਜਾਣਾ ਪੈਂਦਾ ਹੈ ਅਤੇ ਉੱਥੋਂ ਹੀ ਪੈਸਿਆਂ ਦਾ ਆਦਾਨ ਪ੍ਰਦਾਨ ਕਰਨਾ ਪੈਂਦਾ ਹੈ ਇਸ ਤਰ੍ਹਾਂ ਹੀ ਔਨਲਾਈਨ ਬੈਂਕਿੰਗ ਦੇ ਬਹੁਤ ਸਾਰੇ ਫਾਇਦੇ ਹਨ ਇਸ ਦੇ ਨਾਲ ਅਸ ਸਾਡਾ ਸਮੇਂ ਵੀ ਬਚਦਾ ਹੈ ਅਤੇ ਸਾਡਾ ਕਾ ਸਾਡੇ ਕੋਲ ਇੱਕ ਨਿਸ਼ਾਨੀ ਵੀ ਰਹਿ ਜਾਂਦੀ ਹੈ ਕਿ ਅਸੀਂ ਇਸਨੂੰ ਲੈਣ ਦੇਣ ਕੀਤਾ ਹੈ ਇਸ ਨਾਲ ਲੈਣ ਦੇਣ ਕੀਤਾ ਹੈ ਅਤੇ ਇਹ ਬਹੁਤ ਹੀ ਇੱਕ ਵਧੀਆ ਅਤੇ ਆਸਾਨ ਤਰੀਕਾ ਹੈ ਪੈਸੇ ਨੂੰ ਲੈਣ ਦੇਣ ਦਾ ਅਤੇ ਆਪਣੇ ਕਾਰੋਬਾਰ ਨੂੰ ਸੰਭਾਲਣ ਦਾ ਧੰਨਵਾਦ ਜੀ